ਮੈਂ ਸ਼ੀਤਲ ਕੁਮਾਰੀ ਵਾਸੀ ਮਿਰਜਾਪੁਰ ਜ਼ਿਲ੍ਹਾ ਪਠਾਨਕੋਟ ਦੀ ਰਹਿਣ ਵਾਲੀ ਹਾਂ ਮੈਂ ਦੱਸਣਾ ਚਾਹੁੰਦੀ ਹਾਂ ਕਿ ਪਠਾਨਕੋਟ ਜ਼ਿਲ੍ਹੇ ਦੀਆਂ ਮੌਸਮ ਦੇ ਬਾਰੇ ਪਠਾਨਕੋਟ ਜ਼ਿਲ੍ਹੇ ਦਾ ਮੌਸਮ ਬੜਾ ਹੀ ਵਧੀਆ ਰਹਿੰਦਾ ਹੈ ਕਿਉਂਕਿ ਇਹ ਤਾਂ ਕੁਦਰਤ ਦਾ ਦਸਤੂਰ ਹੈ ਕਦੀ ਗਰਮੀ ਕਦੀ ਸਰਦੀ ਕਦੀ ਵਿੱਚ ਵਿਚਾਲੇ ਦਾ ਮੌਸਮ ਪਰ ਇੱਥੇ ਗਰਮੀ ਵੀ ਥੋੜ੍ਹੀ ਇੱਕ ਦੋ ਮਹੀਨੇ ਹੀ ਪੈਂਦੀ ਹੈ ਅਤੇ ਸਰਦੀ ਵੀ ਇੱਕ ਦੋ ਮਹੀਨੇ ਹੀ ਪੈਂਦੀ ਹੈ ਜਿਸ ਤਰ੍ਹਾਂ ਅਸੀਂ ਜੇਕਰ ਗੱਲ ਕਰੀਏ ਤਾਂ ਕੁਝ ਇਲਾਕੇ ਜਿਸ ਤਰ੍ਹਾਂ ਕਸ਼ਮੀਰ ਜਾਂ ਹੋਰ ਪਹਾੜਾਂ ਵਿੱਚ ਸਦਾ ਹੀ ਸਰਦੀ ਦਾ ਮੌਸਮ ਰਹਿੰਦਾ ਹੈ ਪਰ ਸਾਡਾ ਪਠਾਨਕੋਟ ਜ਼ਿਲ੍ਹਾ ਬੇਸ਼ੱਕ ਨਹਿਰਾਂ ਨਦੀਆਂ ਦੇ ਕਿਨਾਰੇ ਵਸਿਆ ਹੈ ਫਿਰ ਵੀ ਇੱਥੇ ਮੌਸਮ ਬੜਾ ਹੀ ਮਜ਼ੇਦਾਰ ਹੁੰਦਾ ਹੈ ਇੱਥੇ ਜਨਵਰੀ ਫਰਵਰੀ ਵਿੱਚ ਠੰਡ ਦਾ ਜ਼ੋਰ ਬਹੁਤ ਹੁੰਦਾ ਹੈ ਜਾਂ ਜੂਨ ਜੁਲਾਈ ਵਿੱਚ ਗਰਮੀ ਦਾ ਜ਼ੋਰ ਹੁੰਦਾ ਹੈ ਪਰ ਇਹ ਗਰਮੀ ਜਾਂ ਸਰਦੀ ਆਸਾਨੀ ਨਾਲ ਇ ਇਨਸਾਨ ਘੱਲ ਝੱਲ ਸਕਦਾ ਹੈ ਇੱਥੇ ਇਹ ਸਿਸਟਮ ਨਹੀਂ ਹੈ ਕਿ ਕਈ ਸਰਦੀ ਦੇ ਇਲਾਕੇ ਅਜਿਹੇ ਹਨ ਕਿ ਉਨਾਂ ਨੂੰ ਸਾ ਛੱਡ ਕੇ ਸਰਦੀ ਤੋਂ ਬਚਣ ਲਈ ਸਾਨੂੰ ਦੂਜੀਆਂ ਥਾਵਾਂ 'ਤੇ ਜਾਣਾ ਪੈਂਦਾ ਹੈ ਅਤੇ ਕੁਝ ਗਰਮੀ ਦੇ ਇਲਾਕੇ ਅਜਿਹੇ ਹਨ ਕਿ ਉਨਾਂ ਨੂੰ ਛੱਡ ਕੇ ਸਾਨੂੰ ਹੋਰ ਸਰਦੀ ਦੀ ਜਗ੍ਹਾ 'ਤੇ ਜਾਣਾ ਪੈਂਦਾ ਹੈ ਪਰ ਇੱਥੇ ਅਜਿਹਾ ਨਹੀਂ ਹੈ ਜਿੱਥੇ ਮੌਸਮ ਸਦਾ ਹੀ ਮਜ਼ੇਦਾਰ ਰਹਿੰਦਾ ਹੈ ਜੇਕਰ ਅਸੀਂ ਪਠਾਨਕੋਟ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਇੱਥੇ ਮੌਸਮ ਵਿੱਚ ਬਦਲਾਵ ਹੁਣ ਵੀ ਹੁੰਦਾ ਹੈ ਰਹਿੰਦਾ ਹੈ ਕਿਉਂਕਿ ਲੋਕਾਂ ਦਾ ਰੋਜ਼ਾਨਾ ਜੀਵਨ ਬੜਾ ਹੀ ਵਧੀਆ ਤੋਂ ਆਨੰਦਮਈ ਬਤੀਤ ਹੁੰਦਾ ਹੈ ਧੰਨਵਾਦ ਜੀ